ਹੈਲੋ ਹਾਂਜੀ ਭਾਅ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਮੇਰੀ ਸਵਿਗੀ ਵਾਲਿਆਂ ਨਾਲ ਗੱਲ ਹੋਨ ਦੀ ਹੈ ਹਾਂਜੀ ਮੈਂ ਤੁਹਾਨੂੰ ਕਹਿਣਾ ਸੀ ਕਿ ਮੈਂ ਨਾ ਚਪਾਤੀਆਂ ਕਰਾਈਆਂ ਅਤੇ ਨਾਲ ਨਾ ਦਾਲ ਮੱਖਣੀ ਕਰਵਾਈ ਸੀ ਉਹ ਜ਼ਿਆਦਾ ਕੁਆਂਟਿਟੀ ਸੀ ਪਰ ਮੇਰੇ ਗੈਸਟ ਨਾ ਆ ਕੇ ਅਤੇ ਮਿਲ ਕੇ ਚਲੇ ਗਏ ਨੇ ਅਤੇ ਇਸ ਲਈ ਮੈਂ ਤੁਹਾਨੂੰ ਕਹਿਣ ਡਿਆਂ ਕਿ ਤੁਸੀਂ ਨਾ ਮੇਰੀ ਕੁਆਂਟਿਟੀ ਘਟਾ ਦਿਓ ਜਿਸ ਤਰ੍ਹਾਂ ਚਪਾਤੀਆਂ ਦ ਪੰਜ ਦਸ ਚਪਾਤੀਆਂ ਦੀ ਜਗ੍ਹਾ ਪੰਜ ਚਪਾਤੀਆਂ ਕਰ ਦਿਓ ਫਿਰ ਦਾਲ ਹਾਫ਼ ਫੁਲ ਪਲੇਟ ਦਾਲ ਮੱਖਣੀ ਦੀ ਜਗ੍ਹਾ ਹਾਫ਼ ਪਲੇਟ ਕਰ ਦਿਓ ਤਾਂ ਜੋ ਫੂਡ ਵੀ ਨਾ ਵੇਸਟ ਹੋ ਸਕੇ ਅਤੇ ਆਪਾਂ ਖਾ ਵੀ ਸਕੀਏ ਅਤੇ ਇਸ ਕਰਕੇ ਮੈਂ ਤੁਹਾਨੂੰ ਕਹਿਨ ਦਿਆ ਜਲਦੀ ਤੋਂ ਜਲਦੀ ਸੈਂਡ ਭੇਜ ਦਿਓ ਡਿਲੀਵਰੀ ਕਰ ਦਿਓ ਅਤੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਵੇਂ ਐਪ ਤੋਂ ਅਤੇ ਸਵਿੱਗੀ ਐਪ ਤੋਂ ਤਾਂ ਹੋ ਨਹੀਂ ਸਕਦਾ ਕਿਉਂਕਿ ਮੈਨੂੰ ਪੰਜ ਮਿੰਟ ਹੀ ਹੋਏ ਹਲੇ ਔਡਰ ਕੀਤੇ ਹੋਏ ਨੂੰ ਤੇ ਤਾਂ ਜੋ ਮੈਂ ਤਾਂ ਇਸ ਲਈ ਮੈਂ ਤੁਹਾਨੂੰ ਪਰਸਨਲੀ ਕਹਿਣ ਡਿਆਂ ਕਿ ਤੁਸੀਂ ਮੇਰੇ ਨਾ ਕ ਕੁਆਂਟਿਟੀ ਘਟਾ ਦਿਓ ਅਤੇ ਇਸ ਲਈ ਫੂਡ ਵੀ ਨਾ ਵੇਸਟ ਹੋ ਸਕੇ ਅਤੇ ਮੈਂ ਤੁਹਾਨੂੰ ਨਾ ਲੋਕੇਸ਼ਨ ਸੈਂਡ ਕਰ ਦਿੰਦਾ ਇਸ ਨੰਬਰ 'ਤੇ ਅਤੇ ਤੁਸੀਂ ਮਾੜਾ ਜਲਦੀ ਤੋਂ ਜਲਦੀ ਸੈਂਡ ਡਿਲੀਵਰੀ ਕਰ ਦਿਓ ਤਾਂ ਭੁੱਖ ਬੜੀ ਲੱਗੀ ਹੈ ਹਾਂਜੀ ਹਾਂਜੀ ਠੀਕ ਹੈ ਓਕੇ ਥੈਂਕ ਯੂ ਧੰਨਵਾਦ